ਮੇਰਾ ਮਨਪਸੰਦ ਮੌਸਮ ਸਿਆਲ਼ ਹੈ ਜਿਸ ਨੂੰ ਸਰਦੀਆਂ ਵਿੱਚ ਸਰਦੀਆਂ ਵੀ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿਉਂਕਿ ਸਰਦੀਆਂ ਵਿੱਚ ਨਾ ਤਾਂ ਬਹੁਤ ਹੀ ਨਾ ਤਾਂ ਗਰਮੀ ਨਾਲ ਬੁਰਾ ਹਾਲ ਹੁੰਦਾ ਹੈ ਅਤੇ ਨਾ ਹੀ ਜ਼ਿਆਦਾ ਠੰਢ ਵਿੱਚ ਅਕੜ ਹੁੰਦਾ ਹੈ ਸਰਦੀਆਂ ਵਿੱਚ ਅਸੀਂ ਕੱਪੜੇ ਪਾ ਕੇ ਰਜਾਈਆਂ ਵਿੱਚ ਵੀ ਲੁਕ ਜਾਂਦੇ ਹਾਂ ਅਤੇ ਜਿਸ ਨਾਲ ਸਾਨੂੰ ਅਰਾਮ ਵੀ ਮਿਲਦਾ ਹੈ ਅਤੇ ਸਰਦੀਆਂ ਵਿੱਚ ਸਾਡਾ ਰੰਗ ਵੀ ਕਾਲ਼ਾ ਨਹੀਂ ਹੁੰਦਾ ਕਿਉਂਕਿ ਗਰਮੀਆਂ ਕਾਰਨ ਤਾਂ ਧੁੱਪਾਂ ਵਿੱਚ ਘੁੰਮਣ ਕਰਕੇ ਰੰਗ ਵੀ ਬਹੁਤ ਕਾਲ਼ਾ ਹੋ ਜਾਂਦਾ ਹੈ ਅਤੇ ਸਰਦੀਆਂ ਵਿੱਚ ਘਰ ਬੈਠੇ ਅਰਾਮ ਨਾਲ਼ ਚਾਹ ਰਜਾਈ 'ਚ ਪੀਣ ਦਾ ਨਜ਼ਾਰਾ ਹੀ ਅਲੱਗ ਹੁੰਦਾ ਹੈ ਅਤੇ ਸਰਦੀਆਂ ਵਿੱਚ ਜ਼ਿਆਦਾ ਮੀਂਹ ਵੀ ਨਹੀਂ ਪੈਂਦੇ ਅਤੇ ਸਰਦੀਆਂ ਵਿੱਚ ਬਾਹਰ ਬਹਿ ਕੇ ਧੁੱਪ ਸੇਕਣ ਦਾ ਨਜ਼ਾਰਾ ਵੀ ਅਲੱਗ ਹੀ ਹੁੰਦਾ ਹੈ ਅਤੇ ਇਸ ਕਰਕੇ ਸਰਦੀਆਂ ਦਾ ਮੌਸਮ ਮੈਨੂੰ ਸਭ ਤੋਂ ਵਧੀਆ ਲੱਗਦਾ ਹੈ